ਪੰਜ ਅਪ੍ਰੈਲ ਉੱਨੀ ਸੌ ਅਠੱਤਰ ਸਤਾਈ ਮਈ ਦੋ ਹਜ਼ਾਰ ਪੰਜ ਛੇ ਮਾਰਚ ਦੋ ਹਜ਼ਾਰ ਛੇ ਸੋਲ੍ਹਾਂ ਮਈ ਦੋ ਹਜ਼ਾਰ ਦੱਸ ਉੱਨੀ ਅਕਤੂਬਰ ਦੋ ਹਜ਼ਾਰ ਤੇਰਾਂ